ਪੰਜਾਬ ਦੇ ਵਿੱਚ ਵਪਾਰਕ ਖੇਤਰ ਸੱਭਿਆਚਾਰ ਅਤੇ ਸਮਾਜਿਕ ਵਿਕਾਸ ਇਸ ਤਰੀਕੇ ਨਿਭਾਉਣੇ ਕਿ ਲੋਕਾਂ ਨੂੰ ਆਪਸ ਦੇ ਵਿੱਚ ਬਣਾ ਕੇ ਰੱਖਦੇ ਜਿਹੜੇ ਵੀ ਲੋਕ ਆਪਸ ਦੇ ਵਿੱਚ ਵਪਾਰ ਕਰਦੇ ਉਹਨਾਂ ਦਾ ਆਪਸ ਦੇ ਵਿੱਚ ਮਿਲਣ ਜੁਲਣ ਵੱਧਦਾ ਰਹਿੰਦਾ ਹੈ ਅਤੇ ਉਹਨਾਂ ਦੀ ਤਨਖਾਹ ਜੋ ਹੈ ਜਿਹੜਾ ਵੀ ਉਹਨਾਂ ਦੀ ਆਮਦਨ ਹੈ ਉਸ ਦੇ ਨਾਲ ਉਹ ਉਹ ਵਾਧਾ ਕਰਦੀ ਹੈ ਇੱਕ ਇੱਕ ਪਰਟੀਕੁਲਰ ਖੇਤਰ ਦੇ ਵਿੱਚ ਦੀ ਆਮਦਨ ਦੇ ਵਿੱਚ ਵਾਧਾ ਕਰ